ਮੇਰਾ ਨਾਮ ਨੈਨਸੀ ਹੈ ਸਾਡੇ ਪਿੰਡ ਦੇ ਵਿੱਚ ਹਸਪਤਾਲਾਂ ਦੀ ਬਹੁਤ ਘਾਟ ਹੈ ਉੱਥੇ ਸਮੇਂ ਸਿਰ ਦਿਵਾਈਆਂ ਬਿਸਤਰ ਓਕਸਿਜਨ ਸਿਲੰਡਰ ਅਤੇ ਸਰਜਰੀਕਲ ਔਜ਼ਾਰਾ ਦੇ ਰੂਪ ਵਿੱਚ ਬਹੁਤ ਘਾਟ ਹੈ ਸਾਨੂੰ ਸਮੇਂ ਸਿਰ ਇਹ ਚੀਜਾਂ ਦਾ ਪ੍ਰਬੰਧ ਨਹੀਂ ਸੀ ਮਿਲਦਾ ਜਦੋਂ ਕੋਈ ਵਿਅਕਤੀ ਜ਼ਿਆਦਾ ਬਿਮਾਰ ਹੋ ਜਾਂਦਾ ਸੀ ਤਾਂ ਉਹਨਾਂ ਨੂੰ ਚੰਡੀਗੜ੍ਹ ਜਾਂ ਹੋਰ ਕੋਈ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਜਾਂਦਾ ਸੀ ਜਦੋਂ ਕੋਈ ਗਰੀਬ ਆਦਮੀ ਕੋਲ ਨਹ ਪੈਸੇ ਨਹੀਂ ਹੁੰਦੇ ਤਾਂ ਉਹਨਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਜੋ ਕਿ ਸਾਡੇ ਪਿੰਡ ਵਿੱਚ ਇਹ ਉਪਲਬਧ ਨਹੀਂ ਸਨ ਜੇਕਰ ਕਿਸੇ ਨੂੰ ਓਕਸਿਜਨ ਦੀ ਲੋ ਪ੍ਰੋਬਲਮ ਹੁੰਦੀ ਸੀ ਤਾਂ ਉਹਨਾਂ ਨੂੰ ਸਮੇਂ ਸਿਰ ਓਕਸਿਜਨ ਨਹੀਂ ਸੀ ਮਿਲਦੀ ਅਤੇ ਕਈਆਂ ਦੀ ਮੌਤ ਵੀ ਹੋ ਜਾਂਦੀ ਸੀ